ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਹਾਂਜੀ ਤੁਸੀਂ ਹਾਂਜੀ ਤੁਸੀਂ ਬੱਚਿਆਂ ਦੇ ਡਾਕਟਰ ਬੋਲਦੇ ਹੋ ਨਾ ਹਾਂਜੀ ਜੀ ਮੇਰਾ ਬੱਚਾ ਵਾ ਹੈ ਨਾ ਮਤਲਬ ਕਿ ਸੱਤ ਅੱਠ ਸਾਲ ਦਾ ਕਿ ਉਹ ਨਾ ਸੁਸਤ ਜਿਹਾ ਹੀ ਰਹਿੰਦਾ ਵਾ ਅਤੇ ਨਾ ਬਾਹਲਾ ਖੇਡਦਾ ਹੈ ਨਾ ਬਾਹਲਾ ਬੱਚਿਆਂ ਦੇ ਵਿੱਚ ਜਾਣੀ ਕੋਈ ਸ਼ਰਾਰਤਾਂ ਜਿਹੀਆਂ ਕਰਦਾ ਖੁਸ਼ ਨਹੀਂ ਹੁੰਦਾ ਇੰਨਾ ਅਤੇ ਚੁੱਪ ਚਪੀਤਾ ਜਿਹਾ ਹੀ ਰਹਿੰਦਾ ਵਾ ਜਿਵੇਂ ਉਹਨਾਂ ਬਾਰੇ ਜਾਣੀ ਪੁੱਛਣਾ ਚਾਹੁੰਦੀ ਹਾਂ ਹੈ ਨਾ ਬਈ ਕਿਵੇਂ ਕਰੀਏ ਕੀ ਹੈ ਨਾ ਸਲਾਹ ਦਿਓ ਸਾਨੂੰ ਹਾਂਜੀ ਦੱਸੋ ਨਹੀਂ ਕੋਈ ਖ਼ਾਸ ਨੂੰ ਤਾਂ ਦਿਖਾਇਆ ਨਹੀਂ ਗਾ ਸਾਨੂੰ ਤੁਹਾਡੇ ਬਾਰੇ ਦੱਸਿਆ ਸੀ ਕਿਸੇ ਨੇ ਵੀ ਉਹਨਾਂ ਨੂੰ ਪੁੱਛੋ ਤੁਸੀਂ ਡਾਕਟਰ ਸਾਹਿਬ ਨੂੰ ਤੇ ਵੀ ਉਹਨਾਂ ਨੂੰ ਪੁੱਛੋ ਤੁਸੀਂ ਹੈਨਾ ਅਤੇ ਤਾਂ ਕਰਕੇ ਹਾਂਜੀ ਹਾਂਜੀ ਨਹੀਂ ਵੈਸੇ ਤਾਂ ਘਰ ਹੀ ਹੈ ਨਾ ਦਿੰਦੇ ਹਾਂ ਤੇ ਫਿਰ ਉਹ ਖਾਂਦਾ ਵੀ ਬਾਹਲਾ ਨਹੀਂ ਐਂਏ ਹੈ ਨਾ ਵੀ ਖੁਸ਼ ਜਿਹੇ ਹੋ ਕੇ ਮਤਲਬ ਧੱਕੇ ਨਾਲ ਹੀ ਥੋੜ੍ਹਾ ਜਿਹਾ ਹਾਂਜੀ ਹਾਂਜੀ ਹਾਂਜੀ ਨਹੀਂ ਪਾਰਕ 'ਚ ਪਾਰਕ 'ਚ ਵੀ ਲੈ ਕੇ ਜਾਂਦੇ ਹਾਂ ਅਸੀਂ ਵੀ ਥੋੜ੍ਹਾ ਚੁਸਤ ਜਿਹਾ ਰਹੇ ਹੈ ਨਾ ਚੁਸਤ ਹੋ ਜਾਵੇ ਦੇਖ ਕੇ ਬੱਚਿਆਂ ਨੂੰ ਅਤੇ ਨਾਲੇ ਮਾਹੌਲ ਹੋਰ ਹੋ ਜਾਂਦਾ ਬਾਹਰ ਹੈ ਨਾ ਪਾਰਕ ਦੇ ਵਿੱਚ ਅਤੇ ਫਿਰ ਵੀ ਹਾਂਜੀ ਉਹ ਤਾਂ ਜਿਹੜੇ ਹੁਣ ਲੱਗਦੇ ਆ ਮਹੀਨੇ ਪਿੱਛੋਂ ਹੈ ਨਾ ਵੇ ਉਹ ਤਾਂ ਅਸੀਂ ਕਰੀ ਜਾਂਦੇ ਹਾਂ ਸਾਰਾ ਕੁਛ ਕਰਵਾਉਂਦੇ ਹਾਂ ਲਗਵਾਈ ਜਾਂਦੇ ਹਾਂ ਟੀਕੇ ਵਗੈਰਾ ਤਾਂ ਤੇ ਵੀ ਜਾਣੀ ਠੀਕ ਆ ਜੀ ਠੀਕ ਆ ਜੀ ਠੀਕ ਆ ਹਾਂਜੀ ਬਸ ਹਾਂਜੀ ਮਿੱਟੀ 'ਚ ਅਸੀਂ ਖਿਲਾਉਂਦੇ ਹਾਂ ਉਹਨਾਂ ਨੂੰ ਵਿਹੜੇ ਦੇ ਵਿੱਚ ਨਾ ਵੀ ਵਿਹੜਾ ਕੱਚਾ ਵਾ ਸਾਡਾ ਉੱਥੇ ਅਸੀਂ ਉਹਨੂੰ ਬਿਠਾਉਂਦੇ ਹੁੰਦੇ ਹਾਂ ਵੀ ਮਿੱਟੀ ਦੇ ਵਿੱਚ ਖੇਡਦੇ ਆ ਨਾ ਸਾਨੂੰ ਪਹਿਲਾਂ ਵੀ ਕਿਸੇ ਨੇ ਐਂ ਦੱਸਿਆ ਸੀਗਾ ਵੀ ਇੱਕਣ ਹੈ ਨਾ ਖੁੱਲੀ ਜਗ੍ਹਾ 'ਤੇ ਐਂ ਵਿੱਚ ਮਿੱਟੀ 'ਤੇ ਬਿਠਾਓ ਖੇਡੇ ਬੱਚਾ ਬਈ ਵੱਧਦਾ ਫੁੱਲਦਾ ਬੱਚਾ ਵਧੀਆ ਹੈ ਨਾ ਸਿਹਤ ਤਾਂ ਬਣਦੀ ਹੈ ਬੱਚੇ ਦੀ ਅਤੇ ਉਹ ਹਾਂਜੀ ਹਾਂਜੀ ਜਿਵੇਂ ਆਮ ਬੱਚੇ ਹੈ ਨਾ ਸੱਤ ਅੱਠ ਮਹੀਨਿਆਂ ਦੇ ਚੁਸਤ ਬਹੁਤ ਹੁੰਦੇ ਬੜੇ ਜਾਂ ਨਿੱਕੀ ਨਿੱਕੀ ਸ਼ਰਾਰਤਾਂ ਜਿਹੀਆਂ ਹੈ ਨਾ ਬੈਠੇ ਬੈਡ 'ਤੇ ਕਰਦੇ ਰਹਿੰਦੇ ਨੇ ਇਸ ਤਰ੍ਹਾਂ ਨਹੀਂ ਹੈ ਉਹ ਕਰਦਾ ਹੈਗਾ ਘੱਟ ਜਾਣੀ ਕਿ ਕਰਦਾ ਜੇ ਬਾਹਲਾ ਉਹਨੂੰ ਬੁਲਾਓ ਬਲੁਓ ਤਾਂ ਮਾੜਾ ਮੋਟਾ ਹੈ ਨਾ ਤੇ ਇਹ ਵੀ ਕਰਦਾ ਹਾਂਜੀ ਹਾਂਜੀ ਇਹ ਤਾਂ ਹੈ ਹੁੰ ਸਿਹਤ ਵੀ ਇੰਨੀ ਨਹੀਂ ਹੈਗੀ ਜਿਵੇਂ ਸੱਤ ਅੱਠ ਮਹੀਨੇ ਬੱਚੇ ਦੀ ਕਹਿ ਦਿਦੇ ਹਾਂ ਹਾਂਜੀ ਬਹੁਤ ਵਧੀਆ ਸਿਹਤ ਹੁੰਦੀ ਆ ਬੱਚਿਆਂ ਦੀ ਕਈ ਵਾਰ ਪਰ ਕਮ ਲੱਗਦਾ ਨਹੀਂ ਇਹਦਾ ਅੱਠ ਮਹੀਨੇ ਦਾ ਕਮਜ਼ੋਰ ਜਿਹਾ ਹੀ ਲੱਗਦਾ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਅਤੇ ਹਾਂਜੀ ਟਾਈਮ ਵਗੈਰਾ ਤੁਹਾਡਾ ਜੀ ਟਾਈਮ ਟਾਈਮ ਵੀ ਕਿੰਨੇ ਟਾਈਮ ਤੋਂ ਕਿੰਨੇ ਤੋਂ ਕਿੰਨੇ ਵਜੇ ਤੱਕ ਖੁੱਲ੍ਹਾ ਹੁੰਦਾ ਹੋਸਪਿਟਲ ਠੀਕ ਆ ਜੀ ਜੀ ਪਰ ਹਾਂਜੀ ਅਤੇ ਪਰਚੀ ਵਗੈਰਾ ਕਟਵਾਉਣੀ ਪੈਂਦੀ ਹੈ ਪਹਿਲਾਂ ਕਿ ਆ ਆਉਂਦੇ ਹੀ ਮਿਲ ਮਿਲ ਲਈਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ